ਹਾਂ ਹਾਂਜੀ ਅੱਜ ਕੱਲ੍ਹ ਜੀ ਜ਼ਿਆਦਾ ਆਵਾਜਾਈ ਆਵਾਜਾਈ ਕਾਰਨ ਬਹੁਤ ਜ਼ਿਆਦਾ ਵਹੀਕਲ ਹੋ ਚੁੱਕੇ ਹਨ ਤਾਂ ਇਸ ਕਰਕੇ ਐਕਸੀਡੈਂਟਾਂ ਦੀਆਂ ਐਕਸੀਡੈਂਟਾਂ ਜ਼ਿਆਦਾ ਐਕਸੀਡੈਂਟ ਜ਼ਿਆਦਾ ਹੋ ਰਹੇ ਹਨ ਜ਼ਿਆਦਾ ਆਵਾਜਾਈ ਕਰਨ ਪਹਿਲਾਂ ਵਾਲੇ ਲੋਕ ਟਰੇਨਾਂ ਬੱਸਾਂ ਟਰੇਨਾਂ 'ਤੇ ਜਾਂ ਪੈਦਲ ਹਸ ਹਸਪਤਾਲਾਂ ਵਿੱਚ ਜਾਂਦੇ ਸਨ ਅਤੇ ਸਮਾਂ ਸਮਾਂ ਮੈਨੂੰ ਲੱਗਦਾ ਸੀ ਅੱਜ ਕੱਲ੍ਹ ਬਹੁਤ ਵਹੀਕਲ ਤੋਂ ਵਹੀਕਲ ਤਾ ਬਹੁਤ ਹੈ ਪਰ ਪਰ ਉਹ ਹੀ ਜਲਦਬਾਜੀ ਦੇ ਕਾਰਨ ਲੋਕ ਆਵਾਜਾਈ ਆਵਾਜਾਈ ਬਹੁਤ ਹੋਣ ਦੇ ਕਾਰਨ ਲੋਕ ਆਪਣਾ ਨੁਕਸਾਨ ਅ ਕਰ ਬੈਠਦੇ ਹਨ ਐਕਸੀਡੈਂਟ ਵਗੈਰਾ ਹੋਸਪਿਟਲ ਤੱਕ ਹਸਪਤਾਲਾਂ ਤ ਕ ਜਾਣ ਤੱਕ ਵੀ ਸਮਾਂ ਲੱਗ ਜਾਨ ਸਮਾਂ ਨਹੀਂ ਲੱਗਦਾ ਪਰ ਪਹਿਲਾਂ ਵਾਲੇ ਲੋਕ ਪੈਦਲ ਜਾਂਦੇ ਸਨ ਤਾਂ ਹਸਪਤਾਲ ਬ ਘੰਟਿਆਂ ਦੇ ਹਿਸਾਬ ਨਾਲ ਸਮਾਂ ਲੱਗ ਜਾਂਦਾ ਸੀ ਅੱਜ ਕੱਲ੍ਹ ਆਵਾਜਾਈ ਹੋਣ ਕਾਰਨ ਆ ਬਹੁਤ ਹਰ ਹਰ ਘਰ ਘਰ ਵਹੀਕਲ ਹੋਣ ਕਾਰਨ ਲੋਕ ਹੋਸਪਿਟਲ ਤੱਕ ਜਲਦੀ ਪਹੁੰਚ ਜਾਂਦੇ ਹਨ ਅੱਜ ਕੱਲ੍ਹ ਸਰਕਾਰ ਦੁਆਰਾ ਚਲਾਈ ਹੋਈਆਂ ਐਂਬੂਲੈਂਸ ਉਹਨਾਂ ਨੂੰ ਉਹਨਾਂ ਮਰੀਜ਼ਾਂ ਨੂੰ ਪਹੁੰਚਣ ਤੱਕ ਬਹੁਤ ਮਦਦ ਕਰਦੀਆਂ ਹਨ ਅੱਜ ਕੱਲ੍ਹ ਦੇ ਲੋਕ ਅੱਜ ਕੱਲ੍ਹ ਲੋਕ ਆਪ ਹਰ ਘਰ ਵਿੱਚ ਦੋ ਦੋ ਤਿੰਨ ਤਿੰਨ ਵਹੀਕਲ ਹੋਣ ਦੇ ਬਾਵਜੂਦ ਬਾਵਜੂਦ ਵੀ ਐਕਸੀਡੈਂਟਾਂ ਦਾ ਸ਼ਿਕਾਰ ਹੋ ਚੁੱਕੇ ਹਨ ਤਾਂ ਕਿ ਸ਼ਹਿਰਾਂ ਸ਼ਹਿਰਾਂ ਸ਼ਹਿਰਾਂ ਸ਼ਹਿਰਾਂ 'ਚ ਵਿੱਚ ਬਹੁਤ ਆਵਾਜਾਈ ਹੋਣ ਕਾਰਨ ਰਸਤਿਆ ਰਸਤਿਆਂ ਵਿੱਚ ਰੁਕਣ ਕਾ ਰੁਕ ਜਾਂਦੇ ਹਨ ਬਹੁਤ ਆਵਾਜਾਈ ਕਰਕੇ